ਥਰੈਸ਼ਹੋਲਡ ਅਤੇ ਗੋਬਰ ਨੂੰ ਪਾਣੀ ਵਿੱਚ ਮਿਲਾ ਕੇ ਛਿੜਕਣ ਪਿੱਛੇ ਇਹੀ ਤਰਕ ਹੈ ਬਈ ਪੁਰਾਣੇ ਸਮਿਆਂ ਜਿਹੜੇ ਸਾਡੇ ਬਜ਼ੁਰਗ ਸੀਗੇ ਉਹ ਵੈਸੇ ਤਾਂ ਤੀਜੇ ਚੌਥੇ ਦਿਨ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਹਮੇਸ਼ਾ ਆਪਣੇ ਚੁੱਲੇ ਚੌਂਕੇ ਨੂੰ ਅਤੇ ਜਿਹੜਾ ਉਹਨਾਂ ਦਾ ਪ੍ਰਵੇਸ਼ ਦੁਆਰ ਹੁੰਦਾ ਸੀ ਉਹਦੇ ਵਿੱਚ ਗੋਬਰ ਦੇ ਵਿੱਚ ਗੋਬਰ ਨੂੰ ਪਾਣੀ ਵਿੱਚ ਮਿਲਾ ਕੇ ਉਹ ਲੇਪ ਕਰਦੇ ਸੀ ਅਤੇ ਉਹਦਾ ਮਤਲਬ ਇਹੀ ਸੀਗਾ ਕਿ ਸਾਡਾ ਸ਼ੁੱਧ ਹੋ ਗਿਆ ਜੇ ਰਸੋਈ ਦੇ ਵਿੱਚ ਖਾਣਾ ਬਣਾਉਣਾ ਖਾਣਾ ਬਣਾਉਣ ਤੋਂ ਪਹਿਲਾਂ ਬਜ਼ੁਰਗ ਔਰਤਾਂ ਜਿਹੜੀਆਂ ਉਹ ਰਸੋਈ ਨੂੰ ਗੋਬਰ ਅਤੇ ਪਾਣੀ 'ਚ ਮਿਲਾ ਕੇ ਉਹਨੂੰ ਲੇਪ ਕਰਦੀਆਂ ਸੀਆਂ ਸਾਰੇ ਚੁੱਲ੍ਹੇ ਚੌਂਕੇ ਨੂੰ ਸਾਫ਼ ਕਰ ਦੇਣਾ ਉਹਦੇ ਨਾਲ਼ ਬਿਲਕੁਲ ਉਹਨੂੰ ਫਿਰ ਉ ਉਹ ਕਰਨ ਤੋਂ ਬਾਅਦ ਲੇਪ ਕਰਨ ਤੋਂ ਬਾਅਦ ਉਹਦਾ ਛਿੜਕਾਅ ਕਰਨ ਤੋਂ ਬਾਅਦ ਇਹ ਫਿਰ ਉਹਨੂੰ ਮੰਨਦੀਆਂ ਸੀ ਵੀ ਹੁਣ ਇਹ ਸਾਡਾ ਚੁੱਲ੍ਹਾ ਚੌਂਕਾ ਸ਼ੁੱਧ ਹੋ ਗਿਆ ਔਰ ਸ਼ੁੱਧ ਕਰਕੇ ਫਿਰ ਉੱਥੇ ਉਹ ਰੋਟੀ ਪਾਣੀ ਜਿਹੜੀ ਉਹ ਬਣਾਉਂਦੀਆਂ ਸੀਆਂ ਇਹੀ ਤਰਕ ਹੈ ਔਰ ਵਿਸ਼ੇਸ਼ ਦਿਨਾਂ ਦੇ ਵਿੱਚ ਜਿ ਜਿਵੇਂ ਸੰਗਰਾਂਦ ਆ ਗਈ ਜਾਂ ਕੋਈ ਗੁਰਪੁਰਬ ਆ ਗਿਆ ਜਾਂ ਘਰ ਦੇ ਵਿੱਚ ਕੋਈ ਸਪੈਸ਼ਲ ਦਿਨ ਉਹਨੂੰ ਮਨਾਉਣ ਵਾਸਤੇ ਵੀ ਏ ਇਹ ਪ੍ਰਵੇਸ਼ ਦੁਆਰ ਤਾਂ ਇੱਕ ਪਾਸੇ ਬਲਕਿ ਘਰ ਦੇ ਸਾਰੇ ਅੰਦਰਾਂ ਦੇ ਵਿੱਚ ਵਿਹੜੇ ਦੇ ਵਿੱਚ ਵੀ ਇਹ ਜਿਹੜਾ ਛਿੜਕਾਅ ਕਰਕੇ ਇਹਦੇ ਵਿੱਚ ਲੇਪ ਕਰਦੇ ਸੀ ਔਰ ਬਜ਼ੁਰਗ ਇਹਨੂੰ ਬਿਲਕੁਲ ਆਪਣੇ ਘਰ ਨੂੰ ਸ਼ੁੱਧ ਮੰਨਦੇ ਸੀ ਵੀ ਹੁਣ ਇਹ ਸਾਡਾ ਘਰ ਸ਼ੁੱਧ ਹੋ ਗਿਆ ਇਹਦੇ ਵਿੱਚ ਕੋਈ ਜਿਹੜਾ ਉਹ ਕੀੜਾ ਮਕੌੜਾ ਜਾਂ ਕੋਈ ਰੁਗਾਣੂ ਨਹੀਂ ਰਿਹਾ ਬੱਚਿਆਂ ਨੂੰ ਜਿਹੜੀ ਖੇਡਣ ਵਾਸਤੇ ਜਾਂ ਘ ਘਰ ਦੇ ਲੋਕ ਖਾਣਾ ਵੀ ਹੇਠਾਂ ਬੈਠ ਕੇ ਖਾਂਦੇ ਸੀ ਉਹ ਖਾਣਾ ਖਾਣ ਵਾਸਤੇ ਵੀ ਉਹ ਹੇਠਾਂ ਚਾ ਚਪ ਚਾਰਪਾਈ ਵਿਛਾ ਕੇ ਜਾਂ ਖਾਲੀ ਇਸ ਤਰ੍ਹਾਂ ਵੀ ਬਹਿ ਜਾਂਦੇ ਸੀ ਕਿਉਂਕਿ ਉਹ ਮੰਨਦੇ ਸੀ ਵੀ ਇਹ ਜਗ੍ਹਾ ਸ਼ੁੱਧ ਹੋ ਗਈ ਇੱਥੇ ਅਸੀਂ ਬੈਠ ਕੇ ਖਾ ਪੀ ਵੀ ਸਕਦੇ ਹਾਂ ਇਹੀ ਤਰਕ ਹੈ